ਟੈਕਨੋਲਜੀ ਨੇ ਨੌਕਰੀਆਂ ਅਤੇ ਮਕਮ ਦੇ ਮੌਕੇ ਖੋਲਣ ਵਿੱਚ ਬਹੁਤ ਸਹਾਇਤਾ ਕੀਤੀ ਹੈ ਇਸ ਨਾਲ ਕਈ ਖੇਤਰਾਂ ਵਿੱਚ ਨਵੇਂ ਨਵੇਂ ਮੌਕੇ ਪੈਦਾ ਕੀਤੇ ਹਨ ਡਿਜੀਟਲ ਪਲੇ ਪਲੈਟਫਾਰਮ ਟੈਕਨੋਲਜੀ ਨੇ ਰਿਮੋਟ ਵਰਕ ਅਤੇ ਈ ਈਕਮਰਸ ਵਰਗੇ ਖੇਤਰਾਂ ਵਿੱਚ ਬੇਹਦ ਮੌਕੇ ਪੈਦਾ ਕੀਤੇ ਹਨ ਜਿਵੇਂ ਕਿ ਅਪਵਰਕ ਅਤੇ ਐਮਜ਼ੋਨ ਵਰਗੀਆਂ ਨੌਕਰੀਆਂ ਦੀਆਂ ਨਵੀਆਂ ਕਿਸਮਾਂ ਪੈਦਾ ਹੋਈਆਂ ਹਨ ਆਟੋਮੇਸ਼ਨ ਅਤੇ ਏ ਆਈ ਇਹ ਕੰਪਨੀਆਂ ਵਿੱਚੋਂ ਆਟੋਮੇਸ਼ਨ ਅਤੇ ਏ ਆਈ ਦੀ ਵਰਤੋਂ ਨੇ ਨਵੇਂ ਤਰੀਕੇ ਤਕਨੀਕ ਮੌਕੇ ਪੈਦਾ ਕੀਤੇ ਹਨ ਜਿਵੇਂ ਕਿ ਡਾਟਾ ਡਾਟਾ ਸਾਇੰਸ ਮਸ਼ੀਨ ਮਸ਼ੀਨ ਲਰਨਿੰਗ ਇੰਜੀਨੀਅਰਿੰਗ ਅਤੇ ਰੋਬਰ ਰੋਬਰਟਿਕਸ ਇੰਜੀਨੀਅਰ ਐਪਲੀਕੇਸ਼ਨ ਅਤੇ ਵੈੱਬ ਇਹਨਾਂ ਨੇ ਬਹੁਤ ਜ਼ਿਆਦਾ ਸ ਸੁਰੱਖਿਆ ਜੋ ਕਿ ਸਾਨੂੰ ਸੁਰੱਖਿਆ ਵੀ ਦਿੰਦੇ ਹਨ ਜਿਸ ਨਾਲ ਅਸੀਂ ਕੰਪਿਊਟਰ ਸਾਇੰਸ ਅਤੇ ਵੱਖ ਵੱਖ ਕਈ ਡਿਗਰੀਆਂ ਪ੍ਰਾਪਤ ਕਰ ਸਕਦੇ ਹਾਂ ਆਈ ਟੀ ਡਾਟਾ ਸਾਇੰਸ